ਜੇਕਰ ਟਰੈਕਿੰਗ ਦੀ ਗੱਲ ਕਰੀਏ ਤਾਂ ਮੈਨੂੰ ਸ਼ੁਰੂ ਤੋਂ ਹੀ ਟਰੈਕਿੰਗ ਦਾ ਬਹੁਤ ਸ਼ੌਂਕ ਸੀਗਾ ਅਤੇ ਅਸੀਂ ਜਦੋਂ ਵੀ ਦੇਖਦੇ ਸੀਗੇ ਟੀ ਵੀ 'ਤੇ ਜਾਂ ਯੂਟਿਊਬ 'ਤੇ ਅਤੇ ਲੋਕ ਹੇਮਕੁੰਟ ਸਾਹਿਬ ਦੀ ਟਰੈਕਿੰਗ ਕਰਦੇ ਸੀਗੇ ਤਾਂ ਸਾਡਾ ਵੀ ਬਹੁਤ ਮਨ ਸੀਗਾ ਜਾਨ ਦਾ ਫਿਰ ਇੱਕ ਦਿਨ ਜਦੋਂ ਸਾਡੇ ਗ੍ਰੈਜੂਏਸ਼ਨ ਦੇ ਇਗਜ਼ਾਮ ਖਤਮ ਹੋਏ ਤਾਂ ਮੈਂ ਆਪਣੇ ਦੋਸਤ ਨਾਲ ਹੇਮਕੁੰਟ ਸਾਹਿਬ ਜਾਣ ਦਾ ਵਿਚਾਰ ਬਣਾਇਆ ਅਸੀਂ ਦੋਨੋਂ ਇੱਥੋਂ ਨਿਕਲ ਗਏ ਟਰੈਕਿੰਗ ਵਾਸਤੇ ਅਸੀਂ ਜਦੋਂ ਉੱਥੇ ਟਰੈਕਿੰਗ ਕੀਤੀ ਤਾਂ ਅਸੀਂ ਉੱਥੋਂ ਦੇ ਬਹੁਤ ਹੀ ਅਦਭੁਤ ਨਜ਼ਾਰੇ ਦੇਖੇ ਉਸ ਨੂੰ ਆਪਣੇ ਮੋਬਾਇਲ ਦੇ ਵਿੱਚ ਫੋਟੋਆਂ ਖਿੱਚੀਆਂ ਬਹੁਤ ਹੀ ਵੀਡੀਓਜ਼ ਬਣਾਈਆਂ ਅਤੇ ਉਸ ਨਜ਼ਾਰੇ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਦੇਖਿਆ ਅਤੇ ਅਸੀਂ ਉੱਥੋਂ ਦੇ ਲੋਕਾਂ ਦੀ ਜ਼ਿੰਦਗੀ ਬਾਰੇ ਵੀ ਬਹੁਤ ਹੀ ਬਰੀਕੀ ਨਾਲ ਦੇਖਿਆ ਕਿ ਉਹ ਲੋਕ ਇੰਨੀ ਠੰਡ ਦੇ ਵਿੱਚ ਇੱਥੇ ਕਿਸ ਤਰ੍ਹਾਂ ਜੀਅ ਰਹੇ ਹਨ ਅਤੇ ਕਿਸ ਤਰ੍ਹਾਂ ਆਪਣਾ ਕੰਮ ਕਰ ਰਹੇ ਹਨ ਅਤੇ ਆਪਣੀ ਰੋਜ਼ੀ ਰੋਟੀ ਕਮਾ ਰਹੇ ਹਨ ਅਸੀਂ ਉਹਨਾਂ ਵੱਲ ਦੇਖ ਕੇ ਬਹੁਤ ਹੀ ਜ਼ਿਆਦਾ ਆਕਰਸ਼ਕ ਹੋਏ ਕਿ ਉਹ ਕਿਸ ਤਰ੍ਹਾਂ ਇੰਨੀ ਠੰਡ ਦੇ ਵਿੱਚ ਕੰਮ ਕਰ ਰਹੇ ਹਨ ਅਤੇ ਲੋਕਾਂ ਦੀ ਇੱਕ ਤਰ੍ਹਾਂ ਨਾਲ ਉਹ ਲੋਕਾਂ ਦੀ ਭਲਾਈ ਹੀ ਕਰ ਰਹੇ ਹਨ ਕਿ ਇੰਨੀ ਠੰਡ ਦੇ ਵਿੱਚ ਕੰਮ ਕਰਨਾ ਬਹੁਤ ਮੁਸ਼ਕਿਲ ਹੈ